ਪੰਜਾਬ ਵਿੱਚ ਜਿਹੜੇ ਕਿ ਸਾਡੇ ਸਿਹਤ ਸੰਭਾਲ ਕਰਮਚਾਰੀ ਉਨ੍ਹਾਂ ਨੇ ਕਾਫੀ ਅੱਛੇ ਕੋਲਜਿਸ ਦੇ ਵਿੱਚੋਂ ਅਤੇ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਅਤੇ ਕਾਫੀ ਉੱਚ ਕੋਟੀ ਦੀਆਂ ਉਹਨਾਂ ਕੋਲ ਡਿਗਰੀਆਂ ਹੈਗੀਆਂ ਵਾ ਅਤੇ ਕਈ ਤਾਂ ਇਹੋ ਜਿਹੇ ਕੋਲਜ ਦੇ ਵਿੱਚੋਂ ਪੜ੍ਹ ਕੇ ਨਿਕਲੇ ਹੋਏ ਆ ਕਿ ਜਿੰਨ੍ਹਾਂ ਦੇ ਵਿੱਚ ਉਹਨਾਂ ਨੂੰ ਪੂਰੀ ਮੈਡੀਕਲ ਟ੍ਰੇਨਿੰਗ ਦਿੱਤੀ ਜਾਂਦੀ ਆ ਅਤੇ ਕਾਫੀ ਅੱਛੇ ਆਪਣੇ ਆਪ ਨੂੰ ਉਹ ਸੰਬੋਧਿਤ ਕਰਦੇ ਹੈਗੇ ਆ ਮਰੀਜ਼ਾਂ ਨੂੰ ਸਾਂਭਣ ਦੇ ਵਿੱਚ ਤੇਅ ਸਾਡੇ ਜਿਹੜੇ ਰਾਜ ਵਿੱਚ ਸਿਹਤ ਸੰਭਾਲ ਪੇਸ਼ਾਵਰ ਆ ਉਹਨਾਂ ਵਾ ਉਹਨਾਂ ਅੱਗੇ ਕਾਫੀ ਮੁੱਖ ਚੁਣੌਤੀ ਆਉਂਦੀਆਂ ਹਨ ਅਤੇ ਜਿਵੇਂ ਕਿ ਕਈ ਵਾਰੀ ਉਹਨਾਂ ਕੋਲ ਕੋਈ ਇਹੋ ਜਿਹਾ ਪੇਸ਼ੈਂਟ ਆ ਜਾਂਦਾ ਹੈ ਵੀ ਜਿਹਦੀ ਇਨਫੈਕਸ਼ਨ ਡੋਕਟਰ ਨੂੰ ਵੀ ਉਹ ਸਕਦੀ ਆ ਅਤੇ ਉਹਨੂੰ ਸਾਰੀ ਆਪਣੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਗਲਵਜ਼ ਮਾਸਕ ਸੈਨਟਾਈਜ਼ਰ ਅਤੇ ਜੇ ਕਿਤੇ ਬਾਈ ਚਾਂਸ ਉਹਨੂੰ ਹੋਮ ਵਿਜਿਟ ਕਰਨਾ ਪੈ ਜੇ ਤਾਂ ਉਹਨੂੰ ਆਪਣੀ ਸੇਫਟੀ ਕਿੱਟ ਨਾਲ ਲੈ ਕੇ ਜਾਣੀ ਪੈਂਦੀ ਹੈਗੀ ਆ ਅਤੇ ਅਤੇ ਜਦੋਂ ਹੋਮ ਵਿਜਿਟ ਕਰਦਾ ਤਾਂ ਉਹਦੇ ਅੱਗੇ ਚੁਣੌਤੀ ਸਮੇਂ ਦੀ ਵੀ ਆਉਂਦੀ ਕਿਉਂਕਿ ਉਹਨੂੰ ਸਮੇਂ ਦੇ ਹਿਸਾਬ ਨਾਲ ਜਲਦ ਤੋਂ ਜਲਦ ਮਰੀਜ਼ ਦੇ ਕੋਲ ਪਹੁੰਚ ਕੇ ਉਹਦਾ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ ਹੈਗਾ